ਜਿਵੇਂ ਕਈ ਪੌਦਿਆਂ ਪੌਦਿਆਂ ਬਾਰੇ ਤਾਂ ਸਾਨੂੰ ਪਹਿਲਾਂ ਹੀ ਕੁਛ ਪੌਦਿਆਂ ਬਾਰੇ ਤਾਂ ਸਾਨੂੰ ਪਤਾ ਹੁੰਦਾ ਹੈ ਅਤੇ ਜਿਹਨਾਂ ਬਾਰੇ ਸਾਨੂੰ ਨਹੀਂ ਪਤਾ ਹੁੰਦਾ ਸੁਰਿੰਦ ਸਾਡੇ ਇੱਕ ਕਾਲਜ ਦੇ ਵਿੱਚ ਸੁਰਿੰਦਰ ਸਿੰਘ ਜੇ ਈ ਹੈ ਉਹਨਾਂ ਨੂੰ ਵੀ ਅਸੀਂ ਪੁੱਛ ਲੈਂਦੇ ਹਾਂ ਵੀ ਇਹ ਪੌਦਾ ਕਿਵੇਂ ਲਗਾਇਆ ਜਾਊਗਾ ਤਾਂ ਜਦੋਂ ਅਸੀਂ ਪੌਦੇ ਲਾਉਂਦੇ ਹਾਂ ਫੁੱਲਾਂ ਵਾਲੇ ਪਹਿਲਾਂ ਤਾਂ ਅਸੀਂ ਚੰਗੀ ਤਰ੍ਹਾਂ ਕਿਆਰੀ ਨੂੰ ਤਿਆਰ ਕਰਦੇ ਹਾਂ ਗੁੱਡ ਗਡੱਈਆ ਕਰਦੇ ਹਾਂ ਜੇ ਵਿੱਚ ਉਹਦੇ ਕੋਈ ਪੱਥਰ ਹੁੰਦਾ ਤਾਂ ਉਹ ਵੀ ਕੱਢ ਦਿੰਦੇ ਹਾਂ ਅਤੇ ਆਲੇ ਦੁਆਲੇ ਪੂਰਾ ਜਿਵੇਂ ਘਾਹ ਹੁੰਦਾ ਕੋਈ ਉਹ ਪੂਰਾ ਖੁਰਚ ਕੇ ਅਸੀਂ ਸਹੀ ਕਰ ਦਿੰਦੇ ਹਾਂ ਅਤੇ ਫਿਰ ਉਹਦੇ ਵਿੱਚ ਖਾਦ ਰਲਾਈ ਜਾਂਦੀ ਹੈ ਖਾਦ ਰਲਾਉਣ ਤੋਂ ਬਾਅਦ ਫਿਰ ਵੀ ਉਹਨੂੰ ਕਹੀ ਨਾਲ ਚੰਗੀ ਤਰ੍ਹਾਂ ਰਲਾਉਦੇ ਹਾਂ ਅਤੇ ਫਿਰ ਉਹਦੇ ਵਿੱਚ ਅਸੀਂ ਪੌਦੇ ਲਗੋ ਲਗਾ ਦਿੰਦੇ ਹਾਂ ਅਤੇ ਪੌਦੇ ਲਗਾਉਣ ਤੋਂ ਬਾਅਦ ਜਦੋਂ ਫਿਰ ਉਹਦੇ ਵਿੱਚ ਪਾਣੀ ਪਾਇਆ ਜਾਂਦਾ ਹੈ ਪਾਣੀ ਪਾਉਣ ਤੋਂ ਬਾਅਦ ਕੁਛ ਦਿਨਾਂ ਬਾਅਦ ਉਹਦੀ ਜਦੋਂ ਜੜ ਫੜ ਲੈਂਦੇ ਨੇ ਤਾਂ ਫਿਰ ਅਸੀਂ ਉਹਦੇ ਵਿੱਚ ਥੋੜ੍ਹਾ ਜਿਹਾ ਰੇਹ ਪਾ ਦਿੰਦੇ ਹਾਂ ਜਿਵੇਂ ਯੂਰੀਆ ਰੇਹ ਹੋਇਆ ਜੀ ਹੋਰ ਜਿਵੇਂ ਥੋੜ੍ਹੇ ਦਿਨਾਂ ਬਾਅਦ ਉਹਨਾਂ ਨੂੰ ਜਦੋਂ ਕੋਈ ਜੇ ਕੋਈ ਪਰੇਸ਼ਾਨੀ ਆਉਂਦੀ ਹੈ ਜਿਵੇਂ ਕੋਈ ਬਿਮਾਰੀ ਲੱਗਦੀ ਹੈ ਜਾਂ ਸਿਉਂਕ ਲੱਗਦੀ ਹੈ ਤਾਂ ਉਸਦੇ ਵਿੱਚ ਅਸੀਂ ਸਿਉਂਕ ਦੀ ਦਵਾਈ ਵੀ ਪਾਉਂਦੇ ਹਾਂ ਅਤੇ ਜਦੋਂ ਪੱਤੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਸੋਹਰਾ ਲੱਗ ਜਾਂਦਾ ਤਾਂ ਉਹਦੇ ਉੱਤੇ ਅਸੀਂ ਸਪਰੇਅ ਵੀ ਕਰਦੇ ਹੈ ਸਪਰੇਅ ਅਤੇ ਅਸੀਂ ਇੱਕਣਾ ਇਹਨਾਂ ਦੀ ਦੇਖਭਾਲ ਕਰਦੇ ਹਾਂ ਅਤੇ ਜ਼ਿਆਦਾ ਤੋਂ ਜ਼ਿਆਦਾ